ਭੰਗੜਾ ਪੰਜਾਬੀ ਗੱਭਰੂਆਂ ਦਾ ਹਰਮਨ ਪਿਆਰਾ ਲੋਕ ਨਾਚ ਹੈ ਕਈ ਵਿਦਵਾਨ ਭੰਗੜੇ ਨੂੰ ਵਿਸਾਖੀ ਦੇ ਨਾਲ ਜੋੜਦੇ ਹਨ ਕਿਉਂਕਿ ਕਿਸਾਨ ਦੀ ਫਸਲ ਪੱਕੀ ਹੁੰਦੀ ਹੈ ਫਸਲਾਂ ਨੂੰ ਵੇਖ ਕੇ ਕਿਸਾਨ ਦਾ ਨੱਚਣ ਨੂੰ ਜੀਅ ਕਰਦਾ ਹੈ ਅਜੋਕੇ ਸਮੇਂ ਵਿੱਚ ਲੋਕ ਨਾਚ ਦਾ ਮੂਲ ਭਾਵ ਮਸਤੀ ਜੋਸ਼ ਜਾਂ ਪਿਆਰ ਹੁੰਦਾ ਹੈ ਖੁਸ਼ੀ ਸਮੇਂ ਨੱਚੇ ਜਾਣ ਵਾਲੇ ਇਸ ਲੋਕ ਨਾਚ ਨਾਲ ਪਹਿਰਾਵਾ ਵੀ ਖਾਸ ਹੁੰਦਾ ਹੈ ਭੰਗੜਾ ਪਾਉਣ ਵਾਲੇ ਗੱਭਰੂਆਂ ਦੁਆਰਾ ਤਿੱਲੇਦਾਰ ਜੁੱਤੀ ਨੋਕ ਵਾਲੀ ਜੁੱਤੀ ਜਾਂ ਖੁੱਸਾ ਪਾਇਆ ਜਾਂਦਾ ਹੈ ਤੇੜ ਚਾਦਰਾ ਕਲੀਆਂ ਵਾਲਾ ਕੁੜਤਾ ਅਤੇ ਰੰਗਦਾਰ ਨਹਿਰੂ ਕੱਟ ਜੈਕਟ ਪਾਈ ਜਾਂਦੀ ਹੈ ਜੋ ਅਕਸਰ ਤਿੱਲੇਦਾਰ ਕਢਾਈ ਨਾਲ ਸ਼ਿੰਗਾਰੀ ਹੁੰਦੀ ਹੈ ਭੰਗੜਾ ਪਾਉਂਦੇ ਸਮੇਂ ਪਗੜੀ ਬੰਨਣ ਦੇ ਕਈ ਨਮੂਨੇ ਪ੍ਰਚਲਿਤ ਹਨ ਜਿਵੇਂ ਆਸ ਪਾਸ ਦੋਨੇ ਸ਼ਮਲੇ ਥੱਲੇ ਨੂੰ ਲਮਕਾ ਕੇ ਇੱਕ ਸ਼ਮਲਾ ਥੱਲੇ ਅਤੇ ਇੱਕ ਉੱਤੇ ਨੂੰ ਉਠਾ ਕੇ ਇਹ ਸ਼ਮਲਾ ਹੇਠਾਂ ਅਤੇ ਦੂਜਾ ਮੱਥੇ ਉੱਪਰ ਕਲਗੀ ਵਾਂਗ ਸਜਾ ਕੇ ਆਦਿ ਸ਼ਮਲਾ ਕੋਈ ਵੀ ਹੋਵੇ ਪਰ ਸ਼ਮਲਾ ਮਾਵੇ ਨਾਲ ਅਕੜਾ ਕੇ ਬੰਨੇ ਜਾਣ ਦਾ ਪ੍ਰਚਲਤ ਹੈ ਪਗੜੀਆਂ ਅਤੇ ਜੈਕਟਾਂ ਦਾ ਰੰਗ ਵੀ ਇੱਕ ਦੂਜੇ ਨਾਲੋਂ ਭਿੰਨ ਰੱਖਿਆ ਜਾਂਦਾ ਹੈ ਤਾਂ ਜੋ ਤੇਜ਼ ਗਤੀ ਵਿੱਚ ਨੱਚੇ ਜਾਣ ਸਮੇਂ ਨੱਚਦਿਆਂ ਦੀ ਦਿਖ ਨੂੰ ਸੁੰਦਰ ਬਣਾ ਸਕੇ ਭੰਗੜਾ ਪਾਉਣ ਵਾਲੇ ਨੌਜਵਾਨਾਂ ਵਿੱਚ ਦੇ ਕੰਨਾਂ ਵਿੱਚ ਨੱਤੀਆਂ ਗਲ ਵਿੱਚ ਕੈਂਠਾ ਆਦਿ ਪਾਉਂਦੇ ਹਨ